ਸਤਿ ਸ਼੍ਰੀ ਅਕਾਲ ਜੀ ਜਿੱਥੇ ਤੱਕ ਬਿਜਲੀ ਦਾ ਸਵਾਲ ਹੈ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਤੇ ਆਮ ਤੌਰ ਤੇ ਅਠਾਰਾਂ ਤੋਂ ਵੀਹ ਘੰਟੇ ਬਿਜਲੀ ਆਉਂਦੀ ਹੈ ਅਤੇ ਇਸ ਕਾਰਨ ਸਾਡੇ ਰੋਜ਼ਾਨਾ ਦੇ ਕੰਮਾਂ ਤੇ ਤਾਂ ਕੋਈ ਬਹੁਤੀ ਰੁਕਾਵਟ ਤੇ ਨਹੀਂ ਆਉਂਦੀ ਪਰ ਹਾਂ ਇਹ ਵੀ ਹੈ ਕੀ ਗਰਮੀ ਦੇ ਮੌਸਮ ਵਿੱਚ ਬੜੇ ਲੰਬੇ ਕੱਟ ਲੱਗਦੇ ਹਨ ਜਿਸ ਕਾਰਨ ਗਰਮੀਆਂ ਦੇ ਸਮੇਂ ਵਿੱਚ ਸਾਨੂੰ ਜਿਆਦਾ ਦਿੱਕਤ ਮਹਿਸੂਸ ਹੁੰਦੀ ਹੈ ਇਸ ਦਾ ਇੱਕ ਕਾਰਨ ਓਵਰਲੋਡਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਲੋਕਾਂ ਨੇ ਅੱਜ ਕੱਲ ਆਪਣੇ ਘਰਾਂ ਵਿੱਚ ਚਾਰ ਤੋਂ ਪੰਜ ਏ ਸੀ ਲਗਾਏ ਹੋਏ ਹਨ ਜੋ ਕੀ ਉਹਨਾਂ ਦੀ ਲੋੜ ਤੋਂ ਕਿਤੇ ਵੱਧ ਵੀ ਹਨ ਜਿਸ ਕਾਰਨ ਉਸ ਇਲਾਕੇ ਦੀ ਬਿਜਲੀ ਤੇ ਬੜਾ ਗੂੜਾ ਪ੍ਰਭਾਵ ਪੈਂਦਾ ਤੇ ਹੋਰ ਲੋਕਾਂ ਨੂੰ ਵੀ ਬੜੀ ਤਕਲੀਫ ਹੁੰਦੀ ਹੈ ਮੇਰੇ ਖਿਆਲ ਨਾਲ ਲੋਕਾਂ ਨੂੰ ਆਪਣੀ ਲੋੜ ਦੇ ਮੁਤਾਬਿਕ ਹੀ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਬਿਜਲੀ ਨੂੰ ਬਚਾਣਾ ਚਾਹੀਦਾ ਕਿਸੇ ਹੱਦ ਤੱਕ ਮੇਰੇ ਹਿਸਾਬ ਨਾਲ ਪ੍ਰਸ਼ਾਸਨ ਨੂੰ ਵੀ ਬਿਜਲੀ ਦੀ ਸਹੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿਉਂਕਿ ਬਾਰ ਬਾਰ ਬਿਜਲੀ ਦੇ ਜਾਣ ਕਰਕੇ ਕਈ ਵਾਰ ਲੋਕਾਂ ਨੂੰ ਬੜੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਬਥੇਰੇ ਨੁਕਸਾਨ ਵੀ ਹੋ ਸਕਦੇ ਨੇ ਮੈਨੂੰ ਅੱਜ ਵੀ ਯਾਦ ਹੈ ਮੇਰੇ ਬਾਰਵੀਂ ਦੇ ਬੋਰਡ ਦੇ ਪੇਪਰਾਂ ਵਿੱਚ ਤੂਫਾਨ ਆਉਣ ਕਰਕੇ ਬਿਜਲੀ ਦਾ ਬੜਾ ਲੰਮਾ ਕੱਟ ਲੱਗਿਆ ਸੀ ਤੇ ਮੈਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਸੋ ਮੇਰੇ ਹਿਸਾਬ ਨਾਲ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਵੀ ਇਸ ਲਈ ਇਸ ਮੁੱਦੇ ਤੇ ਬੜੇ ਕੜੇ ਕਦਮ ਚੁੱਕਣੇ ਚਾਹੀਦੇ ਨੇ ਅਤੇ ਲੋੜ ਅਨੁਸਾਰ ਵੀ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਜਾਇਆ ਨਹੀਂ ਕਰਨਾ ਚਾਹੀਦਾ ਧੰਨਵਾਦ